ਅਸੀਂ ਜੀ ਆਵਾਜਾਈ ਦੇ ਸਾਧਨ ਘਰ ਦੇ ਵਿੱਚ ਮੋਟਰਸਾਈਕਲ ਸਕੂਟਰ ਅਤੇ ਸਕੂਟਰੀ ਰੱਖੇ ਹਨ ਅਤੇ ਬਾਇਸਾਈਕਲ ਵੀ ਰੱਖਿਆ ਹਨ ਅਤੇ ਜੋ ਕਿ ਚਲਾਉਣ ਦੇ ਵਿੱਚ ਸਰੀਰ ਲਈ ਤੰਦਰੁਸਤੀ ਰਹਿੰਦੀ ਹਨ ਅਤੇ ਇੱਕ ਵਾਰੀ ਸਾਡਾ ਪ੍ਰੋਗਰਾਮ ਬਣਿਆ ਵੀ ਅਸੀਂ ਕਿਸੇ ਗੁਰੂ ਦਰਬਾਰ ਸਾਹਿਬ ਜਾ ਕੇ ਆਈਏ ਉਸ ਤੋਂ ਸਾਡੀ ਮੇਰੇ ਯਾਰਾਂ ਦੋਸਤਾਂ ਨਾਲ ਸਲਾਹ ਕੀਤੀ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਬੱਸ ਜਾਈਏ ਕਿ ਟ੍ਰੇਨ ਜਾਈਏ ਆਵਾਜਾਈ ਅਤੇ ਫੇਰ ਅਸੀਂ ਅਸੀਂ ਸਾਨੂੰ ਟ੍ਰੇਨ ਦਾ ਸਫ਼ਰ ਬਹੁਤ ਪਸੰਦ ਆਇਆ ਹੈ ਕਿ ਜਦੋਂ ਮਰਜ਼ੀ ਬਾਥਰੂਮ ਕਰੀਏ ਦੋ ਨੰਬਰ ਜਾਈਏ ਅਤੇ ਸਹੂਲਤ ਹੈ ਬੱਸ ਵਿੱਚ ਨਹੀਂ ਇਹ ਸਾਧਨ ਮਿਲਦੇ ਹਨ ਅਤੇ ਉੱਥੋਂ ਅਸੀਂ ਗਏ ਦਿੱਲੀ ਦਿੱਲੀ ਤੋਂ ਅਸੀਂ ਟ੍ਰੇਨ ਬਦਲੀ ਕੀਤੀ ਟ੍ਰੇਨ ਬਦਲੀ ਕਰਕੇ ਅਸੀਂ ਗੁਰਦੁਆਰਾ ਸ਼੍ਰੀ ਪਟਨਾ ਸਾਹਿਬ ਦਰਬਾਰ ਸਾਹਿਬ ਪਹੁੰਚੇ ਹਨ ਉੱਥੇ ਅਸੀ ਉੱਥੋਂ ਅਸੀਂ ਟੈਂਪੂ ਕਰਕੇ ਅੱਗੇ ਗੁਰੂਘਰ ਦੇ ਪਟਨਾ ਸਾਹਿਬ ਗੁਰੂ ਗੁਰੂ ਦਰਬਾਰ ਗੁਰੂ ਦੇ ਦਰਬਾਰ ਸਾਹਿਬ ਪਹੁੰਚੇ ਜਦੋਂ ਗੁਰੂ ਦਰਬਾਰ ਸਾਹਿਬ ਦੇ ਅਸੀਂ ਦਰਸ਼ਨ ਕੀਤੇ ਕਿ ਸਾਨੂੰ ਬਹੁਤ ਪਸੰਦ ਆਇਆ ਅਤੇ ਸਾਡਾ ਬਹੁਤ ਜੀਅ ਲੱਗਿਆ ਅਸੀਂ ਉ ਉੱਥੇ ਇਹ ਸਾਨੂੰ ਬੈਠਣਾ ਗੁਰੂਘਰ ਦੇ ਵਿੱਚ ਬਹੁਤ ਪਸੰਦ ਆਇਆ ਸਾਨੂੰ ਆਲੇ ਦੁਆਲੇ ਤੁਰਨੇ ਫਿਰਨੇ ਨੂੰ ਨਹੀਂ ਦਿਲ ਕੀਤਾ ਕਿ ਅਸੀਂ ਆਪਾਂ ਐਡੀ ਦੂਰੋਂ ਆਏ ਹਨ ਅਸੀਂ ਗੁਰੂ ਗੁਰਬਾਣੀ ਦੇ ਨਾਲ ਜੁੜ ਕੇ ਦਸ਼ਮੇਸ਼ ਪਿਤਾ ਜੀ ਦੇ ਗੀ ਗੀਤ ਸੁਣੀਏ ਅਤੇ ਗੀਤ ਗਾਈਏ ਅਤੇ ਉਸ ਤੋਂ ਬਾਅਦ ਅਸੀ ਤਿੰਨ ਦਿਨ ਰਹੇ ਸੀਗੇ ਉਹ ਤੋਂ ਬਾਅਦ ਫੇਰ ਅਸੀਂ ਸੋਚਿਆ ਵੀ ਬੱਸ ਚੱਲੀਏ ਸਫ਼ਰ ਕਿ ਟ੍ਰੇਨ ਦਾ ਕਰੀਏ ਮੇਰੇ ਦੋਸਤ ਕਹਿੰਦੇ ਹਨ ਗੱਡੀ ਵਿੱਚ ਸਫਰ ਬਹੁਤ ਸਾਡੇ ਪਸੰਦ ਆਇਆ ਹਨ ਅਤੇ ਸਾਨੂੰ ਬਹੁਤ ਸਹੂਲਤ ਹਨ ਅਸੀਂ ਤਾਂ ਅੱਜ ਤੋਂ ਬਾਅਦ ਆਪਣਾ ਸਫਰ ਰੇਲ ਗੱਡੀ ਦੇ ਟ੍ਰੇਨ ਦੇ ਰਾਹੀਂ ਕੀਤਾ ਜਾਵੇਗਾ